ਟਰੈਕ ਪੂਰਾ ਹੋਣ ਤੋਂ ਬਾਅਦ ਦਾ ਅਹਿਸਾਸ ਟਰੈਕ ਪੂਰਾ ਹੋਣ ਤੋਂ ਬਾਅਦ ਦਾ ਅਹਿਸਾਸ ਕੀ ਹੈ ਟਰੈਕ ਪੂਰਾ ਹੋਣ ਤੋਂ ਬਾਅਦ ਅਹਿਸਾਸ ਹੈ ਜਿਵੇਂ ਕਿ ਤੁਸੀਂ ਕੋਈ ਵੱਡੀ ਜਿੱਤ ਜਿੱਤ ਲਈ ਹੋਵੇ ਕੋਈ ਵੱਡੀ ਲੜਾਈ ਜਿੱਤ ਲਈ ਹੋਵੇ ਜਿੱਦਾਂ ਕਿ ਸਾਰੀ ਖੁਸ਼ੀਆਂ ਤੁਹਾਡੇ ਥੱਲੇ ਰਹਿ ਗਈ ਹੋਣ ਜਿੱਦਾਂ ਕਿ ਤੁਸੀਂ ਹਰ ਕਿਸੇ ਤੋਂ ਉੱਪਰ ਉੱਠ ਗਏ ਹੋ ਟਰੈਕ ਪੂਰਾ ਹੋਣ ਦੀ ਖੁਸ਼ੀ ਇੱਕ ਅਨੋਖੀ ਹੀ ਖੁਸ਼ੀ ਹੈ ਇਹ ਬਿਲਕੁਲ ਉਸ ਖੁਸ਼ੀ ਦੀ ਤਰ੍ਹਾਂ ਹੈ ਜੋ ਖੁਸ਼ੀ ਤੁਸੀਂ ਸ਼ੁਰੂ ਕਰਨ ਵੇਲੇ ਤੋਂ ਪਹਿਲਾਂ ਦੀ ਸੋਚੀ ਦੀ ਹੁੰਦੀ ਹੈ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤਾਂ ਇਹ ਹੀ ਲਕਸ਼ ਲੈ ਕੇ ਚਲਦੇ ਹਾਂ ਕਿ ਚੋਟੀ ਤੱਕ ਪੁੱਜਣਾ ਹੈ ਅਤੇ ਜਦੋਂ ਚੋਟੀ 'ਤੇ ਪੁੱਜ ਜਾਈਏ ਤਾਂ ਉਹ ਇੱਕ ਬਹੁਤ ਹੀ ਚੰਗਾ ਅਹਿਸਾਸ ਹੁੰਦਾ ਹੈ ਜਦੋਂ ਵੀ ਅਸੀਂ ਟਰੈਕ ਕਰਦੇ ਹਾਂ ਤਾਂ ਅਸੀਂ ਕਈ ਜਗ੍ਹਾ 'ਤੇ ਥੱਕਦੇ ਹਾਂ ਉੱਠਦੇ ਹਾਂ ਬਹਿੰਦੇ ਹਾਂ ਸੌਦੇ ਹਾਂ ਖਾਂਦਿਆਂ ਪੀਂਦਿਆਂ ਪਰ ਸਾਡਾ ਬਸ ਇੱਕੋ ਮਕਸਦ ਹੁੰਦਾ ਹੈ ਕਿ ਉੱਪਰ ਤੱਕ ਪਹੁੰਚਣਾ ਹੈ ਚਾਹੇ ਜੋ ਮਰਜ਼ੀ ਹੋ ਜਾਵੇ ਇਸ ਕਰਕੇ ਹੀ ਅਸੀਂ ਆਪਣੇ ਟਰੈਕ ਨੂੰ ਪੂਰਾ ਕਰਨ ਦੇ ਮਿਸ਼ਨ ਵਿੱਚ ਲੱਗ ਜਾਂਦੇ ਹਾਂ ਇੱਕ ਦੂਜੇ ਦਾ ਸਹਾਰਾ ਲੈ ਕੇ ਇੱਕ ਦੂਜੇ ਨੂੰ ਪ੍ਰੋਸਾਹਿਤ ਕਰਕੇ ਉੱਪਰ ਤੱਕ ਪਹੁੰਚ ਜਾਂਦੇ ਹਾਂ ਜਦੋਂ ਅਸੀਂ ਉੱਪਰ ਪਹੁੰਚ ਜਾਈਏ ਤਾਂ ਆਪਣੀ ਪੂਰੀ ਕੀਤੀ ਹਰ ਮੰਜ਼ਿਲ 'ਤੇ ਸਾਨੂੰ ਮਾਣ ਹੁੰਦਾ ਹੈ ਜਦੋਂ ਅਸੀਂ ਉਸ ਚੋਟੀ ਨੂੰ ਦੇਖ ਕੇ ਥੱਲੇ ਦੇਖੀਏ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ ਤਾਂ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ ਜਦੋਂ ਅਸੀਂ ਆਪਣਾ ਲਾਇਆ ਹੋਇਆ ਝੰਡਾ ਉੱਥੇ ਗਾਡ ਦੇਈਏ ਤਾਂ ਉਹ ਇੱਕ ਬਹੁਤ ਹੀ ਜ਼ਿਆਦਾ ਮਾਣ ਭਰਿਆ ਸਮਾਂ ਬਣ ਜਾਂਦਾ ਹੈ ਅਸੀਂ ਸੋਚਦੇ ਹੀ ਰਹਿ ਜਾਂਦੇ ਹਾਂ ਕਿ ਅਸੀਂ ਜੋ ਸੋਚਿਆ ਸੀ ਕਿ ਉਹ ਪੂਰਾ ਹੋ ਗਿਆ ਹੈ ਸਾਡੇ ਨਾਂ ਦਾ ਝੰਡਾ ਇੱਥੇ ਲੱਗ ਗਿਆ ਹੈ ਸਾਡੀ ਮਿਹਨਤ ਵੀ ਇੱਥੇ ਪੂਰੀ ਹੋ ਗਈ ਹੈ ਇਸ ਵਿੱਚ ਆਈ ਕਈ ਕਠਿਨਾਈਆਂ ਤੋਂ ਉੱਪਰ ਉੱਠ ਕੇ ਅਸੀਂ ਹੁਣ ਸਭ ਤੋਂ ਉੱਪਰ ਪਹੁੰਚ ਗਏ ਹਾਂ ਜਦੋਂ ਅਸੀਂ ਉੱਪਰੋਂ ਦੀ ਥੱਲੇ ਦੇਖਦੇ ਹਾਂ ਤਾਂ ਸਾਨੂੰ ਸਭ ਕੁਝ ਇੱਕ ਛੋਟਾ ਜਿਹਾ ਅਭਾਸ ਲੱਗਦਾ ਛੋਟਾ ਛੋਟਾ ਜਿਹਾ ਜਹਾਨ ਲੱਗਦਾ ਹਰ ਲੋਕ ਆਉਂਦੇ ਛੋਟੇ ਛੋਟੇ ਦਿਖਦੇ ਹਨ ਹਰ ਸਾਡੀ ਪਾਰ ਕੀਤੀ ਮੰਜਿਲ ਛੋਟੀ ਛੋਟੀ ਲੱਗਦੀ ਹੈ ਕਿਉਂਕਿ ਹੁਣ ਅਸੀਂ ਸਭ ਤੋਂ ਵੱਡੇ ਹੋ ਚੁੱਕੇ ਹੁੰਦੇ ਹਨ ਅਸੀਂ ਸਭ ਤੋਂ ਉੱਪਰ ਆ ਚੁੱਕੇ ਹੁੰਦੇ ਹਾਂ ਜਦੋਂ ਅਸੀਂ ਆਪਣੇ ਪਾਰ ਕੀਤਿਆਂ ਹੋਇਆਂ ਫੁੱਲ ਬੂਟਿਆਂ ਝਰਨਿਆਂ ਨੂੰ ਦੇਖਦੇ ਹਾਂ ਤਾਂ ਉਹ ਹੋਰ ਵੀ ਜ਼ਿਆਦਾ ਮਨਮੋਹਕ ਲੱਗਦੇ ਹਾਂ ਕਿਉਂਕਿ ਹੁਣ ਸਾਡੀ ਖੁਸ਼ੀ ਦੁਗਣੀ ਹੋ ਚੁੱਕੀ ਹੁੰਦੀ ਹੈ ਇਹ ਬਿਲਕੁਲ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਛੋਟਾ ਬੱਚਾ ਆਪਣੇ ਕਿਸੇ ਜਿੱਦ ਨੂੰ ਪੂਰਾ ਕਰਵਾਉਣ ਲਈ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਤਾਂ ਜਦੋਂ ਉਹ ਮਿਹਨਤ ਪੂਰੀ ਹੋ ਜਾਵੇ ਤਾਂ ਉਸ ਦੇ ਚਿਹਰੇ 'ਤੇ ਜੋ ਮੁਸਕਾਨ ਆ ਜਾਂਦੀ ਹੈ ਉੱਦਾਂ ਦੀ ਹੀ ਇੱਕ ਮੁਸਕਾਨ ਟਰੈਕ ਕਰਦੇ ਹੋਏ ਸ਼ਖਸ ਦੇ ਚਿਹਰੇ 'ਤੇ ਆ ਜਾਂਦੀ ਹੈ ਜਦੋਂ ਉਹ ਆਪਣਾ ਟਰੈਕ ਪੂਰਾ ਕਰ ਲਵੇ ਸਾਨੂੰ ਆਪਣੇ ਜੀਵਨ ਵਿੱਚ ਵੀ ਇਹ ਪ੍ਰੇਰਨਾ ਇਸਤੇਮਾਲ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਅਸੀਂ ਇੱਕ ਟਰੈਕ ਨੂੰ ਪੂਰਾ ਕਰਨ ਲਈ ਜੀ ਜਾਨ ਲਗਾ ਦਿੰਦੇ ਹਾਂ ਰੁਕਦੇ ਹਾਂ ਪਰ ਫਿਰ ਉੱਠਦੇ ਹਾਂ ਫਿਰ ਉਸਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਸ ਤਰ੍ਹਾਂ ਆਪਣੇ ਜੀਵਨ ਵਿੱਚ ਵੀ ਇੱਕ ਟਰੈਕ ਦੀ ਚੋਟੀ ਮੰਨ ਲਈਏ ਉਸ ਤੱਕ ਪਹੁੰਚਣ ਲਈ ਸਾਨੂੰ ਜਿੰਨੀ ਮਿਹਨਤ ਕਰਨੀ ਪਵੇ ਉਹ ਕਰੀਏ ਕਦੇ ਵੀ ਰੁਕੀਏ ਨਾ ਅਤੇ ਬਸ ਚੱਲਦੇ ਜਾਈਏ ਤਾਂ ਜਦੋਂ ਅਸੀਂ ਉਸ ਚੋਟੀ 'ਤੇ ਪਹੁੰਚ ਜਾਈਏ ਤਾਂ ਜੋ ਅਹਿਸਾਸ ਹੈ ਉਹ ਇੱਕ ਜੰਨਤ ਭਰਿਆ ਅਹਿਸਾਸ ਹੈ ਇਸ ਵੇਲੇ ਤੁਹਾਨੂੰ ਬਸ ਇਹ ਹੀ ਲੱਗਦਾ ਹੈ ਕਿ ਤੁਸੀਂ ਬਹੁਤ ਉੱਪਰ ਹੋ ਉੱਪਰ ਦੇਖਦੇ ਹੋਏ ਆਸਮਾਨ ਨੂੰ ਦੇਖ ਕੇ ਲੱਗਦਾ ਹੈ ਕਿ ਤੁਸੀਂ ਆਸਮਾਨ ਦੇ ਬਹੁਤ ਕਰੀਬ ਹੋ ਅਤੇ ਸਵਰਗ 'ਤੇ ਪਹੁੰਚਣ ਵਾਲੇ ਹੋ ਜਿਵੇਂ ਉਹ ਇਸ ਅਹਿਸਾਸ ਦੁਨੀਆਂ ਦਾ ਸਭ ਤੋਂ ਚੰਗਾ ਅਹਿਸਾਸ ਲੱਗਦਾ ਹੈ ਜੀਵਨ ਵਿੱਚ ਵੀ ਇਸ ਪ੍ਰਕਾਰ ਜਦੋਂ ਅਸੀਂ ਆਪਣੀ ਮਨਚਾਹੀ ਚੋਟੀ 'ਤੇ ਪਹੁੰਚ ਜਾਂਦੇ ਹਾਂ ਤਾਂ ਸਾਡੇ ਲਈ ਉਹ ਸਭ ਤੋਂ ਵਧੀਆ ਗੱਲ ਹੋ ਜਾਂਦੀ ਹੈ ਸਾਡੀ ਹਰ ਮਿਹਨਤ ਦਾ ਫਲ ਮਿਲ ਜਾਂਦਾ ਹੈ ਜਦੋਂ ਤੁਸੀਂ ਥੱਲੇ ਦੇਖਦੇ ਹੋ ਆਪਣੇ ਤੋਂ ਥੱਲੇ ਵਾਲੇ ਲੋਕਾਂ ਵੱਲ ਤਾਂ ਤੁਹਾਡੇ ਲਈ ਇੱਕ ਸ਼ਾਨ ਭਰੀ ਗੱਲ ਹੋ ਜਾਂਦੀ ਹੈ ਕਿ ਅਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰੋਤਸਾਹਨ ਕਰ ਰਹੇ ਹਾਂ ਸਾਡੇ ਵੱਲ ਵੇਖ ਕੇ ਵੀ ਕੋਈ ਨਾ ਕੋਈ ਹੁਣ ਉੱਪਰ ਆਉਣ ਦੀ ਕੋਸ਼ਿਸ਼ ਕਰੇਗਾ ਅਤੇ ਉਹ ਤੁਹਾਡੇ ਲਈ ਇੱਕ ਬਹੁਤ ਹੀ ਮਾਣ ਭਰਿਆ ਸਮਾਂ ਬਣ ਜਾਂਦਾ ਹੈ ਇਸ ਕਰਕੇ ਉਹ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਹੀ ਔਖਾ ਹੋ ਜਾਂਦਾ ਹੈ ਜਦੋਂ ਤੁਸੀਂ ਇਕੱਠੇ ਪੂਰੇ ਸ਼ਹਿਰ ਦਾ ਜਾਂ ਪੂਰੇ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀ ਦ੍ਰਿਸ਼ ਦੇਖਦੇ ਹੋ ਤਾਂ ਤੁਹਾਡੀ ਅੱਖਾਂ ਭਰ ਆਉਂਦੀਆਂ ਹਨ ਤੁਹਾਡਾ ਥੱਲੇ ਜਾਣ ਦਾ ਮਨ ਨਹੀਂ ਹੁੰਦਾ ਪਰ ਥੱਲੇ ਵੀ ਜਾਣਾ ਹੀ ਪੈਂਦਾ ਹੈ ਬਸ ਆਪਣੀ ਉਸ ਉੱਚਾਈ ਨੂੰ ਕਦੇ ਵੀ ਤੁਸੀਂ ਥੱਲੇ ਨਹੀਂ ਲਿਆਉਣਾ ਚਾਹੁੰਦੇ ਇਸ ਕਰਕੇ ਤੁਸੀਂ ਖੁਸ਼ੀ ਅਤੇ ਗਮੀ ਬਹੁਤ ਇਕੱਠੇ ਮਹਿਸੂਸ ਕਰਦੇ ਹੋ ਤਾਂ ਉਹ ਇੱਕ ਬਹੁਤ ਹੀ ਜ਼ਿਆਦਾ ਔਖਾ ਸਮਾਂ ਬਣ ਜਾਂਦਾ ਹੈ ਜਿਸ ਵਿੱਚ ਤੁਹਾਡੀ ਖੁਸ਼ੀ ਅਤੇ ਤੁਹਾਡੇ ਇਹ ਅੱਥਰੂ ਇੱਕ ਨਾਲ ਆ ਰਹੇ ਹੁੰਦੇ ਹਨ ਜਿਸ ਨੂੰ ਤੁਸੀਂ ਭਾਵਨਾ ਵਾ ਭਾਵਨਾਵਾਂ ਵਿੱਚ ਦਰਸਾਉਣਾ ਮੁਸ਼ਕਿਲ ਕਰ ਦਿੰਦੇ ਹੋ ਪਰ ਇਹ ਬਹੁਤ ਬਹੁਤ ਜ਼ਿਆਦਾ ਚੰਗਾ ਅਭਾਸ ਹੁੰਦਾ ਹੈ ਅਤੇ ਅਸ ਅਤੇ ਟਰੈਕ ਦੇ ਪੂਰੇ ਟਰੈਕ ਦੇ ਪੂਰੇ ਟਰੈਕ ਵਿੱਚ ਇਹ ਬਹੁਤ ਜ਼ਿਆਦਾ ਚੰਗਾ ਰਹਿੰਦਾ ਹੈ ਅਤੇ ਟਰੈਕ ਪਿੱਛੇ ਪੂਰੇ ਹੋਣ ਵਾਲੇ ਤੁਹਾਡੇ ਹਰ ਸੁਪਨੇ ਨੂੰ ਬਿਆਨ ਕਰ ਦਿੰਦਾ ਹੈ ਕਿ ਕਿਸ ਤਰ੍ਹਾ ਤੁਹਾਡੀ ਹਰ ਚੀਜ਼ ਦੀ ਕੀਮਤ ਦਾ ਮੁੱਲ ਪੈ ਗਿਆ ਹੈ ਤੁਹਾਡੀ ਮਿਹਨਤ ਦਾ ਮੁੱਲ ਪੈ ਗਿਆ ਹੈ ਅਤੇ ਹੁਣ ਤੁਸੀਂ ਇਸ ਤੋਂ ਉੱਠ ਚੁੱਕੇ ਹੋ ਸਭ ਤੋਂ ਉੱਪਰ ਪੁੱਜ ਚੁੱਕੇ ਹੋ ਅਤੇ ਥੱਲੇ ਦਾ ਜੋ ਦ੍ਰਿਸ਼ ਹੈ ਉਹ ਬਹੁਤ ਬਹੁਤ ਜ਼ਿਆਦਾ ਮਨਮੋਹਕ ਹੁੰਦੇ ਜਾ ਰਿਹਾ ਹੈ ਹਰ ਘੜੀ ਦੇ ਨਾਲ ਨਾਲ ਤੁਹਾਨੂੰ ਉਹ ਬਹੁਤ ਮਨਮੋਹਕ ਲੱਗਦਾ ਹੈ